ਸਾਡੇ ਭਾਰਤ ਵਿੱਚ ਦਾਜ ਪ੍ਰਥਾ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ ਇਹ ਪ੍ਰਥਾ ਪੰਜਾਬ ਵਿੱਚ ਵੀ ਮੰਨੀ ਜਾਂਦੀ ਹੈ ਵਿਆਹ ਸਮੇਂ ਕੁੜੀ ਨੂੰ ਕੁਝ ਤੋਹਫ਼ੇ ਦਾਜ ਵਜੋਂ ਪ੍ਰਦਾਨ ਕੀਤੇ ਜਾਂਦੇ ਹਨ ਜਿਵੇਂ ਮੋਟਰਸਾਈਕਲ ਕਾਰ ਫਰਿੱਜ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਹੋਰ ਸਮਾਨ ਜਿਵੇਂ ਕੱਪੜੇ ਗਹਿਣੇ ਆਦਿ ਵਿਆਹ ਵਜੋਂ ਇਹ ਸਮਾਨ ਕੁੜੀਆਂ ਵਾਲਿਆਂ ਦੁਆਰਾ ਮੁੰ ਵਿਆਹ ਵਾਲੇ ਮੁੰਡੇ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਵਿਆਹ ਦੇ ਸਮੇਂ ਮੁੰਡਾ ਜੋ ਚਾਹੇ ਆਪਣੇ ਸਹੁਰਿਆਂ ਘਰ ਤੋਂ ਮੰਗ ਸਕਦਾ ਹੈ ਉਹ ਆਪਣੀ ਪਸੰਦ ਅਨੁਸਾਰ ਆਪਣੇ ਘਰਦਿਆਂ ਆਪਣੇ ਘਰਦਿਆਂ ਸਹੁਰਿਆਂ ਮੂਹਰੇ ਇਹ ਜੋ ਚਾਹੇ ਡਿਮਾਂਡ ਰੱਖ ਸਕਦਾ ਹੈ ਉਹਦਾ ਜੋ ਦਿਲ ਕਰੇ ਉਹ ਮੰਗ ਸਕਦਾ ਹੈ ਅਤੇ ਉਸਦੀ ਇਸ ਡਿਮਾਂਡ ਨੂੰ ਪੂਰਾ ਵੀ ਕੀਤਾ ਜਾਂਦਾ ਹੈ ਜਿਸ ਨੂੰ ਤੋਹਫ਼ਿਆਂ ਦਾ ਨਾਂ ਦਿੱਤਾ ਜਾਂਦਾ ਹੈ ਇਹ ਤੋਹਫ਼ੇ ਤੋਹਫ਼ੇ ਨਹੀਂ ਹੁੰਦੇ ਇਸ ਨੂੰ ਦਾਜ ਵਜੋਂ ਮੰਨਿਆਂ ਜਾਂਦਾ ਹੈ